ਜੀ ਸਾਡੇ ਸਕੂਲ ਵਿੱਚ ਮਦਰਜ਼ ਡੇ 'ਤੇ ਕੰਪੀਟੀਸ਼ਨ ਹੋਇਆ ਸੀ ਜਿਸ ਵਿੱਚ ਮੈਂ ਪਾਰਟੀਸਪੇਟ ਕੀਤਾ ਸੀ ਅਤੇ ਉਸ ਵਿੱਚ ਮੈਂ ਆਪਣੇ ਮਾਤਾ ਜੀ ਦੀ ਮਾਤਾ ਜੀ ਨੂੰ ਦਰਸਾਉਂਦਿਆਂ ਹੋਇਆਂ ਤਸਵੀਰ ਬਣਾਈ ਸੀ ਜਿਸ ਦੀ ਇੱਕ ਸਾਈਡ ਉਹ ਘਰ ਦਾ ਕੰਮ ਸੰਭਾਲ ਰਹੇ ਸੀ ਅਤੇ ਉਹ ਇੱਕ ਸਾਈਡ ਆਪਣੀ ਜੋਬ ਦਾ ਕੰਮ ਸੰਭਾਲ ਰਹੇ ਸੀ ਜਿਵੇਂ ਮੈਂ ਜਿਵੇਂ ਕਿ ਮੇਰੇ ਮਾਤਾ ਜੀ ਟੀਚਰ ਹੈ ਉਹ ਉੱਥੇ ਜੋਬ ਵੀ ਕਰਦੇ ਨੇ ਅਤੇ ਸਾਡੇ ਘਰ ਨੂੰ ਵੀ ਬਖੂਬੀ ਸੰਭਾਲਦੇ ਨੇ ਜਦੋਂ ਮੈਂ ਉਹ ਤਸਵੀਰ ਬਣਾਈ ਕੋਂਪੀਟੀਸ਼ਨ ਵਿੱਚ ਉਸ ਵਕਤ ਬਣਾਉਂਦੇ ਹੋਏ ਮੈਨੂੰ ਇੰਨਾ ਅਹਿਸਾਸ ਨਹੀਂ ਹੋਇਆ ਕਿ ਇਸ ਦਾ ਮੈਸੇਜ ਕਿੰਨਾ ਵੱਡਾ ਹੈ ਲੇਕਿਨ ਉਸ ਤੋਂ ਬਾਅਦ ਬਣਾਉਣ ਤੋਂ ਬਾਅਦ ਮੈਂ ਦੇਖਿਆ ਕਿ ਮੈਨੂੰ ਸੋਚ ਆਈ ਕਿ ਮਾਤਾ ਜੀ ਮੇਰੀ ਮਾਂ ਮੇਰੇ ਮਮਾ ਕਿੰਨਾ ਕੰਮ ਕਰਦੇ ਨੇ ਸਾਰੇ ਪਰਿਵਾਰ ਨੂੰ ਸੰਭਾਲਦੇ ਨੇ ਸਾਨੂੰ ਸੰਭਾਲਦੇ ਨੇ ਫਿਰ ਉਸ ਤੋਂ ਬਾਅਦ ਆਪਣਾ ਕੰਮ ਵੀ ਸੰਭਾਲਦੇ ਨੇ ਆਪਣੇ ਕੰਮ 'ਤੇ ਜਾਂਦੇ ਨੇ ਅਤੇ ਉੱਥੇ ਵੀ ਬਖੂਬੀ ਆਪਣਾ ਕੰਮ ਕਰਦੇ ਨੇ ਉਹ ਸਾਡੇ ਪਰਿਵਾਰ ਦੀ ਹਰ ਲੋੜ ਦਾ ਅਤੇ ਹਰ ਚੀਜ਼ ਦਾ ਧਿਆਨ ਰੱਖਦੇ ਨੇ ਜਿਵੇਂ ਅਸੀਂ ਸਕੂਲ ਜਾਣਾ ਹੁੰਦਾ ਹੈ ਉਹ ਸਵੇਰੇ ਖਾਣਾ ਬਣਾ ਕੇ ਦਿੰਦੇ ਨੇ ਸਾਨੂੰ ਸਾਡਾ ਸਾਨੂੰ ਤਿਆਰ ਕਰਨ ਵਿੱਚ ਸਾਡੀ ਮਦਦ ਕਰਦੇ ਨੇ ਅਤੇ ਫਿਰ ਬਾਅਦ ਵਿੱਚ ਆਪਣਾ ਤਿਆਰ ਹੋ ਕੇ ਉਹਨਾਂ ਨੇ ਜਾਣਾ ਹੁੰਦਾ ਹੈ ਉਹ ਬਹੁਤ ਕੰਮ ਕਰਦੇ ਨੇ